ਏ ਆਈ ਜੋ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਪਰ ਅਸੀਂ ਬਹੁਤ ਸਾਰੇ ਲੋਕ ਇਸ ਬਾਰੇ ਜਾਣੂ ਨਹੀਂ ਸਾਂ ਪਰ ਅੱਜ ਦੇ ਯੁਗ ਵਿੱਚ ਏ ਆਈ ਬਹੁਤ ਹੀ ਪ੍ਰਫੁਲਿੱਤ ਹੋ ਗਈ ਹੈ ਇਸ ਦੇ ਬਹੁਤ ਸਾਰੇ ਫ਼ਾਇਦੇ ਅਤੇ ਬਹੁਤ ਸਾਰੇ ਨੁਕਸਾਨ ਹਨ ਫਾ ਇਸ ਦੇ ਫ਼ਾਇਦੇ ਏ ਜਿਵੇਂ ਕਿ ਬਾਰਡਰਾਂ ਉੱਪਰ ਲੜਨ ਵਾਸਤੇ ਇਸ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਹਾਜ ਚਲਾਉਣ ਵਾਸਤੇ ਹੋਰ ਵੀ ਕਈ ਕਿੱਤਿਆਂ ਵਿੱਚ ਇਸ ਦਾ ਇਸਤੇਮਾਲ ਕਰਕੇ ਇਸ ਤੋਂ ਬਹੁਤ ਸਾਰੇ ਫ਼ਾਇਦੇ ਲਏ ਜਾ ਸਕਦੇ ਹਨ ਪਰ ਇ ਇਸ ਦੇ ਉਲਟ ਇਹਦੇ ਕੁਝ ਨੁਕਸਾਨ ਵੀ ਹਨ ਇਸ ਦੇ ਨੁਕਸਾਨ ਇਸ ਤਰਾਂ ਕੇ ਜਿਵੇਂ ਏ ਆਈ ਟੈਕਨੋਲਜੀ ਨਾਲ ਦਫਤਰਾਂ ਉਸਤਾ ਦੇ ਵਿੱਚ ਇਸ ਤੋਂ ਇਹਨਾਂ ਰਿਪੋਰਟਾਂ ਤੋਂ ਕੰਮ ਲਿਆ ਜਾਵੇਗਾ ਔਰ ਇਸ ਨਾਲ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ ਇਹ ਬਹੁਤ ਵੱਡੀ ਸਮੱਸਿਆ ਹੈ ਇਹ ਇਸ ਨਾਲ ਜਿਹੜੀ ਬੇਰੁਜ਼ਗਾਰੀ ਆਮ ਲੋਕਾਂ ਵਿੱਚ ਆਊਗੀ ਉਸ ਨਾਲ ਬਹੁਤ ਹੀ ਮਾੜੇ ਪ੍ਰਭਾਵ ਪੈਣਗੇ